ਹੈਲੋ ਉਹ ਰਾਹੁਲ ਕੀ ਹਾਲ ਆ ਯਾਰ ਤੇਰਾ ਯਾਰ ਮੈਂ ਤੈਨੂੰ ਕੀ ਦੱਸਾਂ ਬਈ ਮੈਂ ਨਾ ਹੁਣ ਸ਼ਨੀਵਾਰ ਅਤੇ ਐਤਵਾਰ ਦੀ ਦੇਖੋ ਤੈਨੂੰ ਪਤਾ ਛੁੱਟੀ ਹੈ ਘਰ ਬੋਰ ਹੋਈ ਜਾਂਦਾ ਸੀ ਮੈਂ ਕਿਹਾ ਕੋਈ ਨਾ ਕੋਈ ਅਸੀਂ ਵੀ ਜੇ ਦੇਖ ਲਈਏ ਕੋਈ ਨਵੀਆਂ ਨਵੀਆਂ ਲੜੀਆਂ ਆਈਆਂ ਹੋਣਗੀਆਂ ਨਾ ਵੀ ਆਪਾਂ ਵੇਖ ਲਈਏ ਫਿਲਮ ਦੀਆਂ ਕਿਸੇ ਦੀਆਂ ਪਰ ਯਾਰ ਮੇਰੇ ਕੋਲ ਸਮਝ ਨਹੀਂ ਆ ਰਹੀ ਕਿਹੜੀ ਦੇਖਾਂ ਬਸ ਮੈਂ ਇਸ ਲਈ ਮੈਂ ਤੇਰੀ ਸਲਾਹ ਲੈਣਾ ਚਾਹੁੰਦਾ ਵੀ ਤੂੰ ਵੀ ਕੋਈ ਨਾ ਕੋਈ ਦੇਖੀ ਹੋਊਗੀ ਨਾ ਤੂੰ ਮੈਨੂੰ ਉਹ ਕਰ ਦੱਸ ਵੀ ਮੈਂ ਕਿਹੜੀ ਲੜੀ ਦੇਖਾਂ ਠੀਕ ਆ ਵੀ ਮੈਨੂੰ ਤਾਂ ਯਾਰ ਬਿਲਕੁਲ ਹੀ ਸਮਝ ਨਹੀਂ ਆਉਂਦੀ ਦੇਖਣ ਨੂੰ ਜੀਅ ਕਰ ਰਿਹਾ ਗਾ ਨਾਲੇ ਨਹੀਂ ਜੀ ਕਰ ਰਿਹਾ ਵੈਸੇ ਇੱਕ ਉਹ ਨਵੀਂ ਪੰਜਾਬੀ ਫਿਲਮ ਆਈ ਹੈਗੀ ਬੀਬੀ ਰਜਨੀ ਉਹ ਮੈਂ ਵੇਖ ਲਈ ਅਤੇ ਉਹ ਮੈਨੂੰ ਬਹੁਤ ਵਧੀਆ ਲੱਗੀ ਧਾਰਮਿਕ ਮੂਵੀ ਆ ਉਹ ਇੰਨਾ ਜ਼ਿਆਦਾ ਉਹਦੇ ਵਿੱਚ ਮੈਂ ਸੀਰੀਅਸ ਜਿਹਾ ਹੋ ਕੇ ਦੇਖੀ ਅਤੇ ਬਸ ਮੈਂ ਦੱਸ ਨਹੀਂ ਸਕਦਾ ਵੀ ਮੇਰਾ ਹਾਰਟ ਕਿਵੇਂ ਉਹ ਹੋ ਗਿਆ ਅਤੇ ਬਹੁਤ ਅੱਛੀ ਮੂਵੀ ਸੀ ਅਤੇ ਹੁਣ ਮੇਰਾ ਇਰਾਦਾ ਕੋਈ ਐਕਸ਼ਨ ਮੂਵੀ ਹੈ ਨਾ ਜਾਂ ਜਿਵੇਂ ਉਹ ਮਿਰਜਾਪੁਰ ਵਗੈਰਾ ਵਨ ਟੂ ਉਹ ਵੀ ਮੈਂ ਦੇਖ ਲਈਆਂ ਜਾਂ ਜੇ ਕੋਈ ਹੋਰ ਆਈ ਆ ਤਾਂ ਤੂੰ ਮੈਨੂੰ ਉਹ ਸਲਾਹ ਦੇ ਜਿਹੜੀ ਮੈਂ ਦੇਖਾਂ ਜਿਹਦੇ ਨਾਲ ਮੈਨੂੰ ਪੂਰਾ ਵੀਕਐਂਡ ਦਾ ਆਨੰਦ ਜਿਹਾ ਲੈ ਲਈਏ ਆਪਾਂ ਘਰ ਬੈਠੇ ਬੈਠੇ ਹੋਰ ਤਾਂ ਕੋਈ ਗੱਲ ਨਹੀਂ ਹੈ ਨਾ ਅਤੇ ਬਸ ਤੂੰ ਮੈਨੂੰ ਐਂ ਦੱਸ ਦੇ ਵੀ ਮੈਂ ਹੁਣ ਮਿਰਜਾਪੁਰ ਥਰੀ ਦੇਖਾਂ ਜਾਂ ਮੈਂ ਕੋਈ ਹੋਰ ਦੇਖਾ ਜੋ ਕੋਈ ਹੋਰ ਜੇ ਕੋਈ ਤੂੰ ਦੇਖੀ ਆ ਤੈਨੂੰ ਜ਼ਿਆਦਾ ਵਧੀਆ ਲੱਗੀ ਆ ਤਾਂ ਕਿਰਪਾ ਕਰਕੇ ਦੱਸ ਯਾਰ ਮੈਂ ਤਾਂ ਬਾਹਲਾ ਕਨਫਿਊਜ਼ ਹੋਇਆ ਪਿਆ ਟਾਈਮ ਪਾਸ ਹੁੰਦਾ ਨਹੀਂ ਬਸ ਆ ਬੋਰ ਜਿਹਾ ਹੋਈ ਜਾਂਦਾ ਠੀਕ ਆ ਪਲੀਜ਼ ਦੱਸੀ ਵੀਰ ਬਣਕੇ